ਜੀ ਹਾਂ ਮੈਂ ਆਪਣੇ ਸੁਪਨਿਆਂ ਵਿੱਚੋਂ ਇੱਕ ਦੇਸ਼ ਦ੍ਰਿਸ਼ ਪੇਂਟ ਕਰਨਾ ਚਾਹੂੰਗੀ ਉਹ ਹੋਏਗਾ ਪਹਾੜਾਂ ਦੇ ਵਿੱਚ ਮੈਂ ਔਰ ਮੇਰਾ ਪਰਿਵਾਰ ਔਰ ਵੈਸ਼ਨੋ ਮਾਤਾ ਦਾ ਭਵਨ ਅਸੀਂ ਉੱਥੇ ਬਹੁਤ ਅਨੰਦ ਲੈ ਰਵਾਂ ਲਵਾਂਗੇ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਾਂਗੇ ਅਸੀਂ ਉਸ ਦ੍ਰਿਸ਼ ਲਈ ਬਹੁਤ ਸਾਲ ਇੰਤਜ਼ਾਰ ਕੀਤਾ ਅਤੇ ਅੱਜ ਸਾਨੂੰ ਉਹ ਦ੍ਰਿਸ਼ ਦੇਖਣ ਦਾ ਮੌਕਾ ਮਿਲਿਆ ਅਸੀਂ ਸਾਰਾ ਪਰਿਵਾਰ ਬਹੁਤ ਖੁਸ਼ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਰ ਬਾਰ ਇਸ ਦ੍ਰਿਸ਼ 'ਤੇ ਨਜ਼ਦੀਕ ਆਈਏ ਅਤੇ ਇਸ ਦ੍ਰਿਸ਼ ਦਾ ਆਨੰਦ ਮਾਨੀਏ ਮੈਂ ਆਪਣੇ ਬੱਚਿਆਂ ਨੂੰ ਇਸ ਥਾਂ 'ਤੇ ਆਉਣ ਲਈ ਬਾਰ ਬਾਰ ਪ੍ਰੇਰਿਤ ਕਰਾਂਗੀ ਅਤੇ ਬੱਚਿਆਂ ਨੂੰ ਇਸ ਸਥਾਨ ਦਾ ਮਹੱਤਵ ਵੀ ਸਮਝਾਵਾਂਗੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਸਾਰਾ ਪਰਿਵਾਰ ਇਸ ਦ੍ਰਿਸ਼ ਅਤੇ ਇਸ ਥਾਂ ਦੇ ਬਹੁਤ ਹੀ ਨੇੜੇ ਰਹੀਏ ਅਸੀਂ ਬਹੁਤ ਖੁਸ਼ ਸੀ ਅਸੀਂ ਅੱਗੇ ਫਿਰ ਬਾਰ ਬਾਰ ਆਉਣ ਲਈ ਕੋਸ਼ਿਸ਼ ਕਰਾਂਗੇ